ਸਤਿ ਸ਼੍ਰੀ ਅਕਾਲ ਜੀ ਵੈਸੇ ਤਾਂ ਜਿਸ ਇਲਾਕੇ ਵਿੱਚ ਮੈਂ ਰਹਿੰਦੀ ਹਾਂ ਉਸ ਇਲਾਕੇ ਵਿੱਚ ਬਹੁਤ ਹੀ ਸਾਰੇ ਮਸ਼ਹੂਰ ਕਾਲਜ ਹਨ ਪਰ ਅੱਜ ਇੱਕ ਕਾਲਜ ਬਾਰੇ ਮੈਂ ਗੱਲ ਕਰਨ ਜਾ ਰਹੀ ਹਾਂ ਉਹ ਹੈ ਉਹ ਮੇਰੇ ਇਲਾਕੇ ਦਾ ਸਭ ਤੋਂ ਮਸ਼ਹੂਰ ਕਾਲਜ ਹੈ ਅਤੇ ਉਸ ਕਾਲਜ ਦਾ ਨਾਮ ਹੈ ਅਮਨਦੀਪ ਕਾਲਜ ਆਫ ਨਰਸਿੰਗ ਇਹ ਕਾਲਜ ਸਪੈਸ਼ਲ ਈ ਜ਼ਿਆਦਾਤਰ ਉਸ ਬੱਚਿਆਂ ਲਈ ਬਣਾਇਆ ਗਿਆ ਹੈ ਜੋ ਕਿ ਡਾਕਟਰ ਬਣਨਾ ਚਾਹੁੰਦੇ ਹਨ ਅਤੇ ਅਪ ਉਹਨਾਂ ਨੂੰ ਡਾਕਟਰ ਬਣਨ ਦਾ ਬਹੁਤ ਸ਼ੌਂਕ ਹੈ ਇਸ ਕਾਲਜ ਵਿੱਚ ਸਾਨੂੰ ਬਹੁਤ ਹੀ ਜ਼ਿਆਦਾ ਪੜ੍ਹਾਉਂਦੇ ਹਨ ਅਤੇ ਬਹੁਤ ਹੀ ਸਾਡੇ ਸਾਨੂੰ ਵਧੀਆ ਚੀਜ਼ਾਂ ਵੀ ਸਿਖਾਉਂਦੇ ਹਨ ਮੇਰੀ ਭੈਣ ਜੋ ਕਿ ਇਸ ਵੇਲੇ ਬੀ ਐੱਸ ਸੀ ਨਰਸਿੰਗ ਕਰਨ ਦੀ ਹੈ ਉਹ ਇਸ ਕਾਲਜ ਵਿੱਚ ਪੜ੍ਹਦੀ ਹੈ ਅਤੇ ਉਹ ਮੈਨੂੰ ਬਹੁਤ ਹੀ ਜ਼ਿਆਦਾ ਮੇਰੇ ਫਾਇਦੇਮੰਦ ਚੀਜ਼ਾਂ ਮੈਨੂੰ ਆ ਕੇ ਦੱਸਦੀ ਹੈ ਜੋ ਵੀ ਉਸਨੂੰ ਇਸ ਕਾਲਜ ਵਿੱਚ ਪੜ੍ਹਾਇਆ ਜਾਂਦਾ ਹੈ ਇਹ ਕਾਲਜ ਦੇਖਣ ਨੂੰ ਵੀ ਬਹੁਤ ਸੋਹਣਾ ਹੈ ਅਤੇ ਇਸ ਕਾਲਜ ਨੂੰ ਦੇ ਅੰਦਰ ਜਾ ਕੇ ਬਹੁਤ ਹੀ ਸ਼ਾਂਤੀ ਮਿਲਦੀ ਹੈ ਇਸ ਕਾਲਜ ਵਿੱਚ ਕੋਈ ਵੀ ਰੋਲਾ ਰੱਪਾ ਵੀ ਨਹੀਂ ਹੈ ਅਤੇ ਬਹੁਤ ਹੀ ਇਮਾਨਦਾਰੀ ਅਤੇ ਸਾਵਧਾਨੀ ਦੇ ਨਾਲ ਬੱਚੇ ਕੰਮ ਕਰਦੇ ਹਨ ਇਸ ਕਾਲਜ ਦੀਆਂ ਮੈਡਮਾਂ ਵੀ ਬਹੁਤ ਹੀ ਜ਼ਿਆਦਾ ਵਧੀਆ ਹਨ ਅਤੇ ਬੱਚਿਆਂ ਨੂੰ ਬਹੁਤ ਕੁਛ ਸਿਖਾਉਂਦੀਆਂ ਹਨ ਅਤੇ ਬੱਚਿਆਂ ਨੂੰ ਬਹੁਤ ਹੀ ਪ੍ਰੇਰਨਾ ਦਿੰਦੀਆਂ ਹਨ ਕਿ ਉਹ ਵਧੀਆ ਤੋਂ ਵਧੀਆ ਕੰਮ ਕਰ ਸਕਦੇ ਹਨ ਬੱਚੇ ਵੀ ਇਸ ਕਾਲਜ ਦੇ ਬਹੁਤ ਹੀ ਵਧੀਆ ਪੜ੍ਹਦੇ ਹਨ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਮੇਰੀ ਭੈਣ ਵੀ ਵਧੀਆ ਵਧੀਆ ਪੜ੍ਹ ਕੇ ਅੱਗੇ ਹੋਰ ਵੀ ਜਾਣਿਆ ਨੂੰ ਇਹ ਵਧੀਆ ਗੱਲਾਂ ਦੱਸੇਗੀ ਧੰਨਵਾਦ ਜੀ